ਹਾਂਜੀ ਅਸੀਂ ਸਿਮਰਨ ਘੰਟਾ ਦੋ ਘੰਟੇ ਲਗਾਤਾਰ ਅਸੀਂ ਸਿਮਰਨ ਕਰ ਸਕਦੇ ਹਾਂ ਪਰ ਸਿਮਰਨ ਸਾਨੂੰ ਹਮੇਸ਼ਾਂ ਹੀ ਕਰਨਾ ਚਾਹੀਦਾ ਤੁਰਦੇ ਫਿਰਦੇ ਬਹਿੰਦੇ ਉੱਠਦੇ ਅਤੇ ਸਿਮਰਨ ਸਾਡੇ ਵਾਸਤੇ ਸਾਡੇ ਜ ਜ ਇਹ ਵੀ ਇੱਕ ਬਹੁਤ ਜ਼ਰੂਰੀ ਅੰਗ ਹੈ ਇਹ ਸਾਨੂੰ ਇਹ ਵੀ ਸਾਨੂੰ ਡਿਪਰੈਸ਼ਨ ਤੋਂ ਬਚਾਉਂਦਾ ਸਿਮਰਨ ਕਰਨ ਦੇ ਨਾਲ ਸਾਡੇ ਮਨ ਤੁਹਾਡਾ ਮਨੋਬਲ ਵੱਧਦਾ ਹੈ ਸਾਡੀ ਮਨ ਨੂੰ ਤਾਕਤ ਮਿਲਦੀ ਹੈ ਅਤੇ ਅਸੀਂ ਅ ਸਵੇਰੇ ਦੋ ਘੰਟੇ ਸਿਮਰਨ ਕਰਦੇ ਹਾਂ ਅਤੇ ਸ਼ਾਮ ਨੂੰ ਵੀ ਘੰਟਾ ਕੁ ਤੁਰਦੇ ਫਿਰਦੇ ਬਹਿੰਦੇ ਉੱਠਦੇ ਵੀ ਸਾਰਾ ਦਿਨ ਸਿਮਰਨ ਕਰਦੇ ਹਾਂ ਕਿਉਂਕਿ ਪਰ ਸਾਡੇ ਪਾਤਸ਼ਾਹ ਦਾ ਹੁਕਮ ਹੈ ਵੀ ਜੇਤਾ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਣ ਗਾਈਐ ਤਾਂ ਇਸ ਕਰਕੇ ਅਸੀਂ ਸਿਮਰਨ ਸਾਸ ਗਰਾਸ ਕਰਨਾ ਹੈ ਅਤੇ ਜਿੰਨੇ ਸਵਾਸ ਅਸੀਂ ਲੈਂਦੇ ਹਾਂ ਉੰਨੇ ਸਵਾਸ ਹੀ ਅਸੀਂ ਸਿਮਰਨ ਕਰਨਾ ਹੈ ਪਰ ਸਿਮਰਨ ਕਰਦਿਆਂ ਸਾਡਾ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਧਿਆਨ ਦੀ ਕਿਉਂਕਿ ਪਾਤਸ਼ਾਹ ਕਹਿੰਦੇ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮਤ ਅਕਥ ਕਹਾਣੀ ਅਤੇ ਇਹ ਅਸੀਂ ਧੁਨ ਵਿੱਚ ਧਿਆਨ ਰੱਖ ਕੇ ਸਿਮਰਨ ਕਰਨਾ ਹੈ ਜੇ ਅਸੀਂ ਧੁਨ ਵਿੱਚ ਧਿਆਨ ਨਹੀਂ ਰੱਖਦੇ ਤਾਂ ਸਾਡਾ ਉਹ ਸਿਮਰਨ ਕੀਤਾ ਅਸਫ਼ਲ ਹੋ ਜਾਂਦਾ ਹੈ ਕਿਉਂਕਿ ਸਾਨੂੰ ਵਿਚਾਰ ਆਈ ਜਾਂਦੇ ਹੈ ਬੰਦੇ ਦੇ ਵਿਚਾਰ ਚੱਲੀ ਜਾਂਦੇ ਇਹ ਜਿਹੜੇ ਵਿਚਾਰ ਆਉਂਦੇ ਆ ਇਹਨਾਂ ਨਾਲ ਇਹ ਵਿਚਾਰ ਸਾਨੂੰ ਡਿਪਰੈਸ਼ਨ 'ਚ ਲੈ ਜਾਂਦੇ ਆ ਅਤੇ ਸਾਨੂੰ ਸਾਨੂੰ ਨੀਂਦ ਨਹੀਂ ਆਉਂਦੀ ਸਾਡਾ ਜਦੋਂ ਸਾਨੂੰ ਨੀਂਦ ਨਹੀਂ ਆਉਂਦੀ ਤਾਂ ਫਿਰ ਸਾਡਾ ਸਾਰਾ ਸਿਸਟਮ ਤਹਿਸ ਨਹਿਸ ਹੋ ਜਾਂਦਾ ਇਸ ਕਰਕੇ ਸਿਮਰਨ ਕਰਨਾ ਸਾਡੀ ਜਿੰਦਗੀ ਵਿੱਚ ਬਹੁਤ ਹੀ ਜ਼ਰੂਰੀ ਹੈ ਅਤੇ ਅਸੀਂ ਸਾਰੇ ਦਿਨ ਤੁਰਦੇ ਫਿਰਦੇ ਬਹਿੰਦੇ ਉੱਠ ਕਰਦੇ ਹਾਂ ਸਾਨੂੰ ਸਾਡੇ ਮਨ ਵਿੱਚ ਸਹਿਜ ਆਉਂਦਾ ਅਤੇ ਜਿਹੜਾ ਕਿ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਸਹਿਜ ਸਬਰ ਸੰਤੋਖ ਦਇਆ ਸੇ ਇਹ ਸਾ ਇਹ ਚੰਗੇ ਚੰਗੇ ਸਾਰੇ ਗੁਣ ਸਿਮਰਨ ਕਰਨ ਨਲਾ ਜਾਂਦੇ ਆ ਤਾਂ ਸਿਮਰਨ ਸਾਨੂੰ ਸਾਸ ਗਰਾਸ ਕਰਨਾ ਜਿੰਨੇ ਸਵਾਸ ਸਾਨੂੰ ਆਉਂਦੇ ਆ ਉੰਨੇ ਸਵਾਸ ਸਾਨੂੰ ਸਿਮਰਨ ਕਰਨ ਦਾ ਹੁਕਮ ਆ ਅਤੇ ਪਰ ਵਿਚਾਰ ਨਹੀਂ ਕੋਈ ਵੀ ਲੈਣਾ ਸਿਮਰਨ ਕਰਦਿਆਂ ਜਿੰਨੇ ਵਿਚਾਰ ਹੋਣਗੇ ਸਾਡਾ ਉਹ ਸਿਮਰਨ ਕਰਨਾ ਨਹੀਂ ਨਿਫਲ ਹੈ ਅਤੇ ਜਿਹਨੂੰ ਅਸੀਂ ਵਿਚਾਰਾਂ ਤੋਂ ਬਚਣਾ ਜਿੰਨੇ ਵਿਚਾਰਾਂ ਤੋਂ ਬਚਾਂਗੇ ਤਾਂ ਉੰਨਾ ਜ਼ਿਆਦਾ ਹੀ ਅਸੀਂ ਆਪਣਾ ਜ਼ਿੰਦਗੀ ਦੇ ਵਿੱਚ ਅੱਗੇ ਜਾ ਸਕਦੇ ਹਾਂ ਅਤੇ ਆਪਣਾ ਇਸ ਕਰਕੇ ਬਹੁਤ ਬਹੁਤ ਧੰਨਵਾਦ ਸਿਮਰਨ ਸਾਡੇ ਲਈ ਬਹੁਤ ਜ਼ਰੂਰੀ ਹੈ